ਭੰਗੜਾ ਇਕ ਤਰ੍ਹਾਂ ਦੀ ਪੂਰੇ ਸਰੀਰ ਦੀ ਇਕ ਵਰਜਿਸ਼ ਹੈ ਇਹ ਸਰੀਰਕ ਅਤੇ ਮਾਨਸਿਕ ਜਾਂ ਦਿਮਾਗੀ ਕਸਰਤ ਹੁੰਦੀ ਹੈ ਅਤੇ ਸਰੀਰਕ ਤੌਰ 'ਤੇ ਮਾਨਸਿਕ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ਇਹ ਸ਼ੌਂਕ ਨਾਲ ਹੀ ਪਾਇਆ ਜਾਂਦਾ ਹੈ ਭੰਗੜਾ ਅਤੇ ਜਦੋਂ ਵੀ ਕੋਈ ਮਤਲਬ ਵੀ ਇਹਦਾ ਵੀ ਤਾਂ ਇਹ ਪੂਰਾ ਤਾਲਮੇਲ ਰੱਖਣਾ ਪੈਂਦਾ ਐਵੇਂ ਨਹੀਂ ਵੀ ਜਿਵੇਂ ਮਤਲਬ ਇਹ ਭੰਗੜਾ ਡੱਗਾ ਲੱਗਾ ਢੋਲ 'ਤੇ ਅਤੇ ਆਪਾਂ ਭੰਗੜਾ ਸ਼ੁਰੂ ਕਰਤਾ ਉਦੋਂ ਪੂਰਾ ਤਾਲਮੇਲ ਨਾਲ ਰੱਖਣਾ ਪੈਂਦਾ ਜਿਹੜੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਹਨ ਉਹ ਸਾਰੇ ਇਵੇਂ ਹੀ ਮਤਲਬ ਜੋ ਵੀ ਭੰਗੜਾ ਪਾਉਂਦੇ ਤਾਲਮੇਲ ਬਣਾ ਕੇ ਪਾਉਂਦੇ ਹਨ ਅਤੇ ਬਾਕੀ ਜਿਵੇਂ ਵੀ ਕੋਈ ਵਿਆਹ ਸ਼ਾਦੀਆਂ 'ਚ ਭੰਗੜੇ ਪੈਂਦੇ ਆ ਉਹ ਤਾਂ ਜਦੋਂ ਵੀ ਢੋਲ ਵੱਜਦਾ ਹੈ ਤਾਂ ਆਪਣੇ ਆਪ ਪੈਰ ਥਿਰਕਣ ਲੱਗ ਜਾਂਦੇ ਵੀ ਆਪਣੇ ਆਪ ਜਿਵੇਂ ਵੀ ਹੋਵੇ ਉਵੇਂ ਹੀ ਭੰਗੜਾ ਪੈ ਜਾਂਦਾ ਇਹ ਇੱਕ ਤਰ੍ਹਾਂ ਦਾ ਲੋਕ ਨਾਚ ਵੀ ਹੈ ਆਪਣਾ ਸਾਰਾ ਅਤੇ ਬਿਮਾਰੀਆਂ ਤੋਂ ਵੀ ਬਚਾਉਂਦਾ ਅਤੇ ਵਰਜਿਸ਼ ਵੀ ਹੁੰਦੀ ਇਹਦੇ ਨਾਲ ਆਪਣੇ ਹੱਥ ਪੈਰ ਸਾਰਾ ਸਰੀਰ ਆਪਣਾ ਹਿਲਦਾ ਮੂੰਹ ਦੀ ਵਰਜਿਸ਼ ਵੀ ਹੁੰਦੀ ਹੈ ਸਾਰੇ ਮੋਢੇ ਗੋਡਿਆਂ ਸਭ ਦੀ ਹਵਾ ਦੀ ਵਰਜਿਸ਼ ਹੁੰਦੀ ਇਹਦੇ ਨਾਲ ਅਤੇ ਜ਼ਰੂਰੀ ਨਹੀਂ ਵੀ ਇਹ ਭੰਗੜਾ ਜਿਹੜਾ ਵੀ ਬੰ ਮੁੰਡੇ ਹੀ ਪਾ ਸਕਦੇ ਕੁੜੀਆਂ ਵੀ ਪਾ ਸਕਦੀਆਂ ਅਤੇ ਹੁਣ ਕੁ ਬਾਕੀ ਇਹ ਭੰਗੜਾ ਲੋਕ ਨਾਚ ਹੈ ਅਤੇ ਭੰਗੜਾ ਸਿਰਫ ਸਿੱਖੇ ਲੋਕ ਨਹੀਂ ਪਾਉਂਦੇ ਸਾਰੇ ਹੀ ਪਾ ਸਕਦੇ ਇਹ ਖੁਸ਼ੀ ਦਾ ਪ੍ਰਗਟਾਵਾ ਹੈ ਭੰਗੜਾ ਅਤੇ ਸਾਨੂੰ ਹਰ ਇੱਕ ਨੂੰ ਇਹ ਮਤਲਬ ਜਿਵੇਂ ਵੀ ਆਉਂਦਾ ਹੋਵੇ ਪਾਉਣਾ ਚਾਹੀਦਾ ਅਤੇ ਆਪਣੇ ਸਰੀਰ ਦੀ ਕਸ ਕਸਰਤ ਕਰਨੀ ਚਾਹੀਦੀ ਹੈ ਇਹਦੇ ਨਾਲ ਤੰਦਰੁਸਤੀ ਹੁੰਦੀ ਸਰੀਰ ਦੀ ਸਾਨੂੰ ਇਹ ਜ਼ਰੂਰ ਕਰਨਾ ਚਾਹੀਦਾ ਅਤੇ ਬਾਕੀ ਬਚਾਉਂਦਾ ਆਪਾਂ ਨੂੰ ਬਿਮਾਰੀਆਂ ਤੋਂ ਇਹ ਬਿਮਾਰੀਆਂ ਤਾਂ ਆਪਣੀਆਂ ਜਿਵੇਂ ਆਪਾਂ ਵਰਜਿਸ਼ ਕਰਦੇ ਹਾਂ ਉਵੇਂ ਹੀ ਇਹ ਭੰਗੜੇ ਦੇ ਨਾਲ ਨਾਲ ਇਹ ਵਰਜਿਸ਼ ਵੀ ਹੈ ਸਾਡੀ ਹੁਣ ਇਹ ਆਪਾਂ ਨੂੰ ਕਰਨਾ ਚਾਹੀਦਾ